ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਭਾਰਤ ਵਿੱਚ ਲਗਭਗ ਸਾਰੇ ਹੀ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਹੀ ਧਰਮਾਂ ਦੇ ਲੋਕ ਆਪੋ ਆਪਣੇ ਤਿਉਹਾਰ ਮਨਾਉਂਦੇ ਹਨ ਕਿਸੇ ਨੂੰ ਵੀ ਆਪਣਾ ਤਿਉਹਾਰ ਮਨਾਉਣ 'ਤੇ ਕੋਈ ਮਨਾਹੀ ਨਹੀਂ ਹੈ ਭਾਰਤ ਵੱਲੋਂ ਅਤੇ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪੂਰੀ ਇਜਾਜ਼ਤ ਅਤੇ ਉਹਨਾਂ ਨੂੰ ਉਨ੍ਹਾਂ ਨਾਲ਼ ਬਰਾਬਰ ਹਿੱਸਾ ਪਾਏ ਜਾਂਦਾ ਹੈ ਅਤੇ ਭਾਰਤ ਵਿੱਚ ਬੜੇ ਹੀ ਤਰ੍ਹਾਂ ਦੇ ਤਿਉਹਾਰ ਹਨ ਜਿਵੇਂ ਕਿ ਦੀਵਾਲੀ ਹੋਲੀ ਲੋਹੜੀ ਅਤੇ ਕਈ ਅਨੇਕ ਹੀ ਤਿਉਹਾਰ ਹਨ

ਜਿਵੇਂ ਕਿ ਦੀਵਾਲੀ ਦੇ ਮੌਕੇ 'ਤੇ ਸ਼੍ਰੀ ਰਾਮ ਚੰਦਰ ਜੀ ਆਪਣਾ ਚੌਦਾਂ ਸਾਲ ਦਾ ਬਨਵਾਸ ਪੂਰਾ ਕਰਕੇ ਆਯੋਧਿਆ ਪਹੁੰਚੇ ਸੀਗੇ ਤਾਂ ਆਯੋਧਿਆ ਵਾਸੀਆਂ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਦੇਸੀ ਘਿਓ ਦੇ ਦੀਵੇ ਬਾਲ਼ ਕੇ ਉਹਨਾਂ ਉਨ੍ਹਾਂ ਦਾ ਸਵਾਗਤ ਕੀਤਾ ਸੀਗਾ ਅਤੇ ਜਿਸਦਾ ਦਾ ਜਿਹੜਾ ਉਹ ਦਿਨ ਹੈ ਤਾਂ ਉਸ ਦਿਨ ਨੂੰ ਦੀਵਾਲੀ ਦੇ ਨਾਂ 'ਤੇ ਜਾਣਿਆ ਜਾਂਦਾ ਹੈ ਤਾਂ ਉਹ ਤਿਉਹਾਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਨਾਇਆ ਜਾਂਦਾ ਹੈ ਅਤੇ ਜਿਵੇਂ ਹੋਲੀ ਦਾ ਤਿਉਹਾਰ ਇਹ ਹੋਲੀ ਦੇ ਤਿਉਹਾਰ ਨੂੰ ਇੱਕ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਲੱਗੋ ਲੱਗ ਰੰਗ ਇੱਕ ਦੂਜੇ ਦੇ ਮੂੰਹ 'ਤੇ ਲਗਾ ਕੇ ਇੱਕ ਦੂਜੇ ਨੂੰ ਵਿਸ਼ ਕੀਤਾ ਜਾਂਦਾ ਹੈ ਅਤੇ ਇਵੇਂ ਹੀ ਭਾਰਤ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਤਿਉਹਾਰ ਅਲੱਗ ਅਲੱਗ ਤਰੀਕੇ ਨਾਲ਼ ਮਨਾਏ ਜਾਂਦੇ ਹਨ